ਵੈਸੇ ਤਾਂ ਰੂਪਨਗਰ ਜ਼ਿਲ੍ਹੇ ਨਾਲ ਬਹੁਤ ਸਾਰੀਆਂ ਦਿਲਚਸਪ ਕਹਾਣੀਆਂ ਹਨ ਇਹਦੇ ਨਾਲ ਮੈਂ ਤੁਹਾਡੇ ਨਾਲ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਦੀ ਇੱਕ ਘਟਨਾ ਚਮਕੌਰ ਦੀ ਗੜੀ ਵਾਲੀ ਉਹ ਸਾਂਝੀ ਕਰਨ ਲੱਗਿਆ ਹੈਗਾ ਹੈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਧੋਖੇ ਨਾਲ ਮੁਗਲਾਂ ਨੇ ਕਿਲ੍ਹਾ ਖਾਲੀ ਕਰਵਾਇਆ ਅਤੇ ਉਹ ਤੋਂ ਉੱਥੋਂ ਤੋਂ ਜਾਂਦੇ ਹੋਏ ਸਰਸਾ ਨਦੀ 'ਤੇ ਉਹਨਾਂ ਦਾ ਪਰਿਵਾਰ ਵਿਛੜ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੋਂ ਜਾਂਦੇ ਹੋਏ ਅੱਗੇ ਚਮਕੌਰ ਸਾਹਿਬ ਦੀ ਗੜੀ ਵਿਖੇ ਆਪਣਾ ਰਹਿਣ ਬਸੇਰਾ ਬਣਾਇਆ ਉੱਥੇ ਉਹਨਾਂ ਨਾਲ ਚਾਲੀ ਸਿੱਖ ਅਤੇ ਦੋ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਉਹਨਾਂ ਨਾਲ ਹੀ ਸੀਗੇ ਅਤੇ ਮੁਗਲਾਂ ਨੇ ਉੱਥੇ ਜਾ ਕੇ ਜਦੋਂ ਉਹਨਾਂ ਨੂੰ ਪਤਾ ਲੱਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉੱਥੇ ਹੈ ਤਾਂ ਉਹਨਾਂ ਨੇ ਪੂਰੇ ਉਹਨਾਂ ਨੂੰ ਗੜੀ ਨੂੰ ਘੇਰਾ ਪਾ ਲਿਆ ਅਤੇ ਘੇਰਾ ਪਾਉਣ ਤੋਂ ਬਾਅਦ ਉੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਸਿੰਘ ਅਤੇ ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਉੱਥੇ ਸ਼ਹੀਦ ਹੋ ਗਏ ਹੈ ਅਤੇ ਉਹਨਾਂ ਦੀ ਯਾਦ ਵਿੱਚ ਦਾਸਤਾਨ ਏ ਸ਼ਹਾਦਤ ਚਮਕੌਰ ਸਾਹਿਬ ਵਿਖੇ ਮਿਊਜ਼ੀਅਮ ਬਣਾਇਆ ਹੈ ਗਿਆ ਹੈ